ਡੇਮ ਡੇਂਗੂ ਬੁਖਾਰ ਅਤੇ ਮਲੇਰੀਆ ਵਰਗੀ ਮੱਛਰਾਂ ਤੋਂ ਹੋਣ ਵਾਲੀ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਬਹੁਤ ਸਾਰੀਆਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਕਿ ਜਿਵੇਂ ਕਿ ਮੱਛਰਾਂ ਤੋਂ ਪੈ ਗੰਦੇ ਪਾਣੀ ਤੋਂ ਹੋਣ ਵਾਲੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਲਈ ਨੇੜੇ ਤੇੜੇ ਪਾਣੀ ਨਹੀਂ ਖੜਨ ਦੇਣਾ ਚਾਹੀਦਾ ਆਪਣੇ ਆਲੇ ਦੁਆਲੇ ਸਾਫ਼ ਸਫਾਈ ਬਣਾਈ ਰੱਖਣੀ ਚਾਹੀਦੀ ਹੈ ਸਾਫ਼ ਸੁਥਰਾ ਪਾਣੀ ਅਤੇ ਸਾਫ਼ ਸੁਥਰਾ ਖਾਣਾ ਖਾਣਾ ਚਾਹੀਦਾ ਹੈ ਫ਼ਲ ਸਬਜੀਆਂ ਦੇ ਬਚੇ ਛਿੱਲੜ ਨੂੰ ਬਾਹਰ ਕ ਕੂੜੇਦਾਨ ਵਿੱਚ ਪਾ ਦੇਣਾ ਚਾਹੀਦਾ ਹੈ ਘਰ ਵਿੱਚ ਜਾਂ ਰੂਮ ਵਿੱਚ ਨਹੀਂ ਰੱਖਣਾ ਚਾਹੀਦਾ ਹੈ ਜਿਹਦੇ ਨਾਲ ਮੱਛਰ ਦੇ ਪੈਦਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਇਹਨਾਂ ਤੋਂ ਬਚਣ ਲਈ ਛੋਟੇ ਜਵਾਕਾਂ ਨੂੰ ਬਚਾਉਣ ਲਈ ਬਹੁਤ ਸਾਰੇ ਯੰਤਰ ਆਉਂਦੇ ਹਨ ਜਿਵੇਂ ਕਿ ਅੱਜ ਕੱਲ੍ਹ ਮਾਰਕੀਟ ਵਿੱਚ ਗੁੱਡ ਨਾਈਟ ਔਡੋਲੀਨ ਵਰਗੇ ਯੰਤਰ ਚੱਲ ਰਹੇ ਹਨ ਜਿਸ ਵਿੱਚ ਲਿਕਵਿਡ ਪਦਾਰਥ ਹੁੰਦੇ ਹਨ ਜੋ ਕਿ ਇਹਨਾਂ ਮੱਛਰਾਂ ਨੂੰ ਮਾਰਦੇ ਹਨ ਅਤੇ ਬੱਚਿਆਂ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਜਿਹੇ ਬਿਮਾਰੀਆਂ ਤੋਂ ਬਚਣ ਲਈ ਬੱਚਿਆਂ ਦਾ ਟੀਕਾਕਰਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਜਿਹੀ ਬਿਮਾਰੀਆਂ ਤੋਂ ਬਚਣ ਲਈ ਹੋਰ ਬਹੁਤ ਸਾਰੇ ਜਿਵੇਂ ਨਿਯਮਾਂ ਦੀ ਪਾਲਨਾ ਕਰਨੀ ਚਾਹੀਦੀ ਹੈ ਆਸ ਪਾਸ ਪਾਣੀ ਨਹੀਂ ਖੜਨ ਦੇਣਾ ਚਾਹੀਦਾ ਗੰਦੀਆਂ ਚੀਜ਼ਾਂ ਦੂਰ ਰਹਿਣਾ ਚਾਹੀਦਾ ਹੈ ਕੂੜਾ ਕਰਕਟ ਕੂੜੇਦਾਨ ਵਿੱਚ ਪਾਣਾ ਚਾਹੀਦਾ ਹੈ ਸਾਫ਼ ਸੁਥਰਾ ਪਹਿਨਾਵਾ ਹੋਣਾ ਚਾਹੀਦਾ ਹੈ ਗੰਦੇ ਪਾਣੀ ਤੋਂ ਦੂਰ ਰਹਿਣਾ ਚਾਹੀਦਾ ਹੈ ਗੰਦੇ ਪਾਣੀ ਤੋਂ ਦੂਰ ਰਹਿਣਾ ਚਾਹੀਦਾ ਹੈ ਗੰਦੀਆਂ ਥਾਵਾਂ 'ਤੇ ਨਹੀਂ ਜਾਣਾ ਚਾਹੀਦਾ ਆਪਣੇ ਹੱਥ ਨੂੰ ਸਾਫ਼ ਸੁਥਰੇ ਡਟੋਲ ਸਾਬਣ ਵਰਗੀਆਂ ਸਾਬਣਾਂ ਨਾਲ ਧੋਣਾ ਚਾਹੀਦਾ ਹੈ ਅੱਜ ਕੱਲ੍ਹ ਬਹੁਤ ਵਧੀਆ ਮਾਰਕੀਟ ਵਿੱਚ ਹੈਂਡ ਵਾਸ਼ ਆ ਗਏ ਹਨ ਜਿਹਨਾਂ ਦੀ ਵਰਤੋਂ ਕਰਕੇ ਇਹਨਾਂ ਮੱਛਰਾਂ ਤੋਂ ਬਚਿਆ ਜਾ ਸਕਦਾ ਹੈ ਮੱਛਰ ਤੋਂ ਪੈਦਾ ਹੋਣ ਵਾਲੀ ਗੰਦੀ ਬਿਮਾਰੀਆਂ ਬਹੁਤ ਹੀ ਖ਼ਤਰਨਾਕ ਹੁੰਦੀਆਂ ਹਨ ਇਹ ਮਰੀਜ਼ ਨੂੰ ਬੈਡ 'ਤੇ ਵੀ ਪਾ ਦਿੰਦੀਆਂ ਹਨ ਅਤੇ ਬਹੁਤ ਬਿਮਾਰ ਕਰ ਦਿੰਦੀਆਂ ਹਨ